ਮੇਰਾ ਨਾਮ ਪਰਮਜੀਤ ਕੌਰ ਹੈ ਅਤੇ ਮੈਂ ਖਰੜ ਦੀ ਰਹਿਣ ਵਾਲੀ ਹਾਂ ਅਤੇ ਮੈਂ ਖਰੜ ਮੈਂ ਵਿਆਹੀ ਹੋਈ ਹਾਂ ਅਤੇ ਮੇਰੇ ਚਾਰ ਬੱਚੇ ਹੈ ਅਤੇ ਤਿੰਨ ਕੁੜੀਆਂ ਅਤੇ ਇੱਕ ਮੁੰਡਾ ਹੈ ਅਤੇ ਮੈਂ ਘਰ ਦਾ ਹੀ ਕੰਮ ਕਰਦੀ ਹਾਂ ਅਤੇ ਆਪਣਾ ਘਰ ਦਾ ਸਾਰਾ ਸੰਭਾਲਦੀ ਹਾਂ ਅਤੇ ਆਪਣੇ ਬੱਚਿਆਂ ਨੂੰ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਬਹੁਤ ਵਧੀਆ ਕਰਿਆ ਹੋਇਆ ਹੈ ਮੈਂ ਅਤੇ ਮੇਰਾ ਘਰਦਾ ਘਰ ਵਾਲਾ ਵੀ ਬਹੁਤ ਵਧੀਆ ਹੈ